ਮੈਂ ਔਨਲਾਈਨ ਲੈਪਟੋਪ ਲਿਆ ਵਾ ਨਾ ਉਹਨੂੰ ਓਲੈਕਸ 'ਤੇ ਜਾਂ ਫੇਸਬੁੱਕ 'ਤੇ ਇੰਸਟਾ 'ਤੇ ਪਾ ਪਾਇਆ ਹੋਇਆ ਵਾ ਉਹਨੂੰ ਮੈਂ ਵੇਚਣਾ ਚਾਹੁੰਦਾ ਵਾਂ ਬਹੁਤ ਵਧੀਆ ਹੈਗਾ ਵਾ ਉਹ ਦੀ ਰੈਮ ਅਤੇ ਉਹਦੀ ਇੰਟਰਨਲ ਮੈਮਰੀ ਬਹੁਤ ਸਟੋਰੇਜ ਹੈਗੀ ਹੈ ਅਤੇ ਲੈਨਵੋ ਦਾ ਲੈਪਟੋਪ ਆ ਬਹੁਤ ਵਧੀਆ ਪ੍ਰੋਸੀਜਰ ਦਾ ਕੰਮ ਕਰ ਸਕਦੇ ਓਂ ਤੁਸੀਂ ਉਹਦੇ 'ਤੇ ਅਤੇ ਮੈਂ ਉਹਨੂੰ ਸੇਲ ਕਰਨਾ ਚਾਨਾ ਵਾਂ ਮੈਂ ਕਾਫ਼ੀ ਮੰਥ ਡੇਢ ਦੋ ਮੰਥ ਤੋਂ ਮੈਂ ਉਹਨੂੰ ਓਲੈਕਸ 'ਤੇ ਫੇਸਬੁੱਕ 'ਤੇ ਇੰਸਟਾ 'ਤੇ ਅਦਰ 'ਤੇ ਵੀ ਪਾਇਆ ਹੋਇਆ ਵਾ ਕਿਸੇ ਚੀਜ਼ ਨੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਉਸ 'ਤੇ ਸਭ ਵਧੀਆ ਹੈ ਜੀ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਹੈ ਫੋ ਦੇ ਮੇਰੇ ਲੈਪਟੋਪ 'ਚ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਵੀ ਜਦੋਂ ਮਰਜ਼ੀ ਮੇਰੇ ਕੋਲ ਵਿਜ਼ਿਟ ਕਰਕੇ ਚੈੱਕ ਵੀ ਕਰ ਸਕਦੇ ਓਂ ਵੇਖ ਵੀ ਸਕਦੇ ਓਂ ਕੋਈ ਪ੍ਰੋਬਲਮ ਨਹੀਂ ਹੈ ਇਹ 'ਚ